ਪੌਦਿਆਂ ਲਈ ਵੱਖ ਵੱਖ ਮੌਸਮਾਂ ਦੇ ਅਧਾਰ 'ਤੇ ਅਸੀਂ ਸਾਵਧਾਨੀਆਂ ਵਰਤਦੇ ਹਾਂ ਕਿ ਜਿਵੇਂ ਗਰਮੀ ਦੇ ਵਿੱਚ ਸਾਨੂੰ ਜ਼ਿਆਦਾਤਰ ਛਾਂ ਦਾਰ ਪੌਦੇ ਲਾਉਣੇ ਚਾਹੀਦੇ ਨੇ ਅਤੇ ਉਹਦੇ ਵਿੱਚ ਸਾਨੂੰ ਵੀ ਰਾਹਤ ਮਿਲਦੀ ਹੈ ਅਤੇ ਉਹਨਾਂ ਦੀਆਂ ਸਾਵਧਾਨੀਆਂ ਵਿੱਚ ਜਿਵੇਂ ਕਿ ਮੋ ਸਮੇਂ ਸਿਰ ਉਹਨਾਂ ਨੂੰ ਪਾਣੀ ਵੱਧ ਤੋਂ ਵੱਧ ਦੇਣਾ ਚਾਹੀਦਾ ਅਤੇ ਗਰਮੀ ਦੇ ਵਿੱਚ ਜ਼ਿਆਦਾ ਥੁ ਪੌਦਿਆਂ ਨੂੰ ਨਵੀਂ ਸਾਨੂੰ ਰੱਖਣੀ ਚਾਹੀਦੀ ਹੈ ਅਤੇ ਪੌਦਿਆਂ ਨੂੰ ਜੋ ਜੋ ਵੀ ਕੋਈ ਕੀਟਨਾਸ਼ਕ ਵਗੈਰਾ ਦੇਣਾ ਹੁੰਦਾ ਜਾਂ ਕੋਈ ਖਾਦ ਸਮੇਂ ਸਮੇਂ ਸਿਰ ਖਾਦ ਦੇਣੀ ਚਾਹੀਦੀ ਹੈ ਅਤੇ ਇਸੇ ਲਈ ਅਸੀਂ ਜਿਵੇਂ ਮੌਸਮ ਬਦਲਣ ਦੇ ਅਧਾਰ 'ਤੇ ਵੱਖ ਵੱਖ ਪੌਦਿਆਂ ਨੂੰ ਅਸੀਂ ਅਲੱਗ ਤਰੀਕੇ ਨਾਲ ਉਹਨਾਂ ਦੀ ਸੰਭਾਲ ਕਰਦੇ ਹਾਂ ਜਿਵੇਂ ਸਰਦੀਆਂ ਦੇ ਵਿੱਚ ਅਸੀਂ ਉਹਨਾਂ ਨੂੰ ਠੰਡ ਤੋਂ ਬਚਾਉਣ ਦੇ ਲਈ ਗਰੀਨ ਹਾਊਸ ਦੀ ਵਰਤੋਂ ਕਰ ਲੈਂਦੇ ਹਾਂ ਅਤੇ ਇਸ ਤਰ੍ਹਾਂ ਹੀ ਅਸੀਂ ਗਰਮੀ ਗਰਮੀ ਦੇ ਵਿੱਚ ਪੌਦਿਆਂ ਨੂੰ ਬਚਾਉਣ ਦੇ ਲਈ ਗ੍ਰੀਨ ਹਾਊਸ ਦੀ ਵਰਤੋਂ ਕਰਦੇ ਹਾਂ ਅਤੇ ਪਾਣੀ ਵੱਧ ਤੋਂ ਵੱਧ ਦਿੰਦੇ ਹਾਂ ਸਰਦੀਆਂ ਦੇ ਵਿੱਚ ਅਸੀਂ ਉਹਨਾਂ ਨੂੰ ਪਾਣੀ ਘੱਟ ਦੇ ਸਕਦੇ ਹਾਂ ਅਤੇ ਉਹਨਾਂ ਨੂੰ ਜਿਹੜੀ ਵੀ ਕੋਈ ਖਾਦ ਜਿਵੇਂ ਆਪਣੇ ਸਬਜ਼ੀਆਂ ਫਲ ਇਹਨਾਂ ਨੂੰ ਇੱਕ ਇਹਨਾਂ ਦੀ ਖਾਦ ਬਣਾ ਕੇ ਉਹਨਾਂ ਨੂੰ ਪੌਦਿਆਂ ਵਿੱਚ ਪਾ ਸਕਦੇ ਹਾਂ ਜੋ ਕਿ ਉਹਨਾਂ ਨੂੰ ਬਹੁਤ ਲਾਭਦਾਇਕ ਹੁੰਦੀ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਗੰਡੋਇਆਂ ਦੀ ਖਾਦ ਦੇ ਸਕਦੇ ਹਾਂ ਅਤੇ ਮਿੱਟੀ ਮਿੱਟੀ ਦੀ ਸਾਂਭ ਸੰਭਾਲ ਵਾਸਤੇ ਸਾਨੂੰ ਸਮੇਂ ਸਮੇਂ ਸਿਰ ਮਿੱਟੀ ਅਸੀਂ ਚੈੱਕ ਵੀ ਕਰਵਾ ਸਕਦੇ ਹਾਂ ਧੰਨਵਾਦ